ਹਾਂਜੀ ਜਿੱਥੇ ਤੱਕ ਬੁਣਨ ਦੀ ਗੱਲ ਆ ਛੋਟੇ ਹੁੰਦੇ ਮੰਮੀ ਕੋਲੋਂ ਥੋੜ੍ਹਾ ਬਹੁਤ ਸਿੱਖਦੇ ਸੀਗੇ ਸਿਲਾਈਆਂ ਦੇ ਉੱਤੇ ਕਿਸ ਤਰ੍ਹਾਂ ਬਣਾਉਣੇ ਆ ਇਹ ਚੀਜ਼ ਕਿਸ ਤਰ੍ਹਾਂ ਬਣਾਉਣੀ ਹੈ ਔਰ ਜਦੋਂ ਮੈਰਿਜ਼ ਤੋਂ ਬਾਅਦ ਬੱਚਿਆਂ ਦੇ ਕੁਛ ਸਵੈਟਰ ਸਵੂਟਰ ਬਣਾਏ ਆ ਪਰ ਕੁਛ ਟਾਈਮ ਪਹਿਲੇ ਨਾ ਅਸ ਅਸੀਂ ਘਰ ਠਾਕੁਰ ਜੀ ਲਿਆਂਦੇ ਸੀ ਠਾਕੁਰ ਜੀ ਵਾਸਤੇ ਨਾ ਮੇਰੇ ਕੋਲ ਕਰੋਸ਼ੀਏ ਦੀ ਕੋਈ ਡਰੈਸ ਨਹੀਂ ਸੀ ਉਹ ਕਰੋਸ਼ੀਆ ਮੈਂ ਕਦੀ ਨਹੀਂ ਬਣਾਇਆ ਸੀ ਇੱਕ ਨਾ ਮੈਂ ਚੇਨ ਆਉਂਦੀ ਸੀ ਬਣਾਉਣੀ ਮੈਂ ਸਿਰਫ ਉਹ ਚੇਨ ਬਣਾ ਲੈਂਦੀ ਹੁੰਦੀ ਸੀ ਕਰੋਸ਼ੀਏ ਦੀ ਅਤੇ ਮੈਂ ਬੜੇ ਸੋਚੀਂ ਪੈ ਗਈ ਕਿ ਮਾਰਕੀਟ 'ਚੋਂ ਕਾਫੀ ਮਹਿੰਗੀ ਉਹਨਾਂ ਦੀ ਡਰੈਸ ਮਿਲ ਰਹੀ ਸੀ ਕਰੋਸ਼ੀਏ ਦੀ ਅਤੇ ਮੇਰੀ ਫਰੈਂਡ ਨੇ ਇਸ ਤਰ੍ਹਾਂ ਹੀ ਕਿਹਾ ਕਿ ਤੁਸੀਂ ਕਰੋਸ਼ੀਆ ਚਲਾ ਲੈਂਦੇ ਹੋ ਤਾਂ ਉਹ ਤੁਸੀਂ ਬਣਾ ਸਕਦੇ ਹੋ ਮੈਂ ਕਿਹਾ ਨਹੀਂ ਮੈਂ ਨਹੀਂ ਬਣਾ ਸਕਦੀ ਕਿਉਂਕਿ ਮੈਨੂੰ ਮੈਂ ਕਰੋਸ਼ੀਆ ਸਿੰਗਲ ਚੇਨ ਬਣਾਉਣੀ ਆਉਂਦੀ ਮੈਨੂੰ ਅੱਗੋ ਡਿਜ਼ਾਇਨਿੰਗ ਨਹੀਂ ਕਰਨੀ ਆਉਂਦੀ ਕਿ ਉਹਨੂੰ ਕਿਸ ਤਰ੍ਹਾਂ ਸ਼ੇਪ ਦੇਣੀ ਕਿ ਉਹ ਡਰੈਸ ਤਿਆਰ ਹੋ ਜੇ ਫਿਰ ਮੈਂ ਹੁਣ ਮੇਰੀ ਫਰੈਂਡ ਨੇ ਮੈਨੂੰ ਸੁਝਾਅ ਦਿੱਤਾ ਕਿ ਤੁਸੀਂ ਨਾ ਯੂਟਿਊਬ 'ਚ ਦੇਖੋ ਕਿ ਉਹ ਕਿਸ ਤਰ੍ਹਾਂ ਬਣਾਉਂਦੇ ਆ ਮੈਂ ਇਸ ਤਰ੍ਹਾਂ ਇੱਕ ਦਿਨ ਲੈ ਕੇ ਬੈਠ ਗਈ ਮੈਂ ਯੂਟੀਊਬ 'ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਕਹੀ ਗਏ ਮੈਂ ਉਸ ਤਰ੍ਹਾਂ ਉਹਨਾਂ ਨੂੰ ਕਰੀ ਗਈ ਕਿਉਂਕਿ ਕਰੋਸ਼ੀਆ ਮੈਨੂੰ ਵੈਸੇ ਚਲਾਉਣਾ ਆਉਂਦਾ ਸੀਗਾ ਉਹ ਜਦੋਂ ਮੈਂ ਕਰੋੋਸ਼ੀਆ ਚਲਾਇਆ ਨਾ ਉਹ ਜਿਸ ਤਰ੍ਹਾਂ ਜਿਸ ਤਰ੍ਹਾਂ ਕਹੀ ਗਏ ਮੈਂ ਬਣਾਈ ਗਈ ਔਰ ਐਨੀ ਕੁ ਅੱਛੀ ਇੱਕ ਸਿੰਪਲ ਸੁੱਭਰ ਜਿਹੀ ਡਰੈੱਸ ਤਿਆਰ ਹੋ ਗਈ ਔਰ ਮੇਰਾ ਮਨ ਐਨਾ ਕੁ ਖੁਸ਼ ਹੋ ਗਿਆ ਔਰ ਉਸ ਤੋਂ ਬਾਅਦ ਮੈਂ ਯੂਟਿਊਬ ਤੋਂ ਦੇਖ ਕੇ ਕਾਫੀ ਮਤਲਬ ਕਿ ਡਰੈਸਿਜ਼ ਬਣਾਈ ਕਾਫੀ ਹੈਵੀ ਹੈਵੀ ਔਰ ਮੇਰੇ ਵੱਲ ਦੇਖ ਕੇ ਮੈਨੂੰ ਕਾਫੀ ਮੇਰੇ ਫਰੈਂਡਸ ਨੇ ਵੀ ਪੁੱਛਿਆ ਕਿ ਮਤਲਬ ਤੁਸੀਂ ਇਹ ਕਿਸ ਤਰ੍ਹਾਂ ਬਣਾਈ ਹੈ ਫਿਰ ਮੈਂ ਉਹਨਾਂ ਨੂੰ ਸਿਖਾਇਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਗਿਫਟ ਵੀ ਕੀਤੇ ਆ ਔਰ ਮਤਲਬ ਮੈਂ ਖੁਦ ਹੈਰਾਨ ਹੈ ਕਿ ਮੈਨੂੰ ਉਮੀਦ ਵੀ ਨਹੀਂ ਸੀਗੀ ਕਿ ਮੈਂ ਐਨੀਆਂ ਅੱਛੀ ਡਰੈਸਿਜ਼ ਬਣਾ ਲਵਾਂਗੀ ਔਰ ਮੈਂ ਕਾਫੀ ਸੇਲ ਨਹੀਂ ਕੀਤੀਆਂ ਇੱਕ ਗਿਫਟ ਹੀ ਕੀਤੀਆਂ ਮਤਲਬ ਓਨੀਆਂ ਮੈਂ ਘਰ ਵਾਸਤੇ ਨਹੀਂ ਬਣਾਈਆਂ ਜਿੰਨੀਆਂ ਕਿ ਡਬਲ ਟ੍ਰਿਪਲ ਮੈਂ ਸੇਲ ਮਤਲਬ ਕਿ ਇਸ ਤਰ੍ਹਾਂ ਦੇਤੀਆਂ ਆਪਣੇ ਫਰੈਂਡਸ ਨੂੰ ਉਹਨਾਂ ਦੇ ਲੱਡੂ ਗੋਪਾਲ ਜੀ ਵਾਸਤੇ ਫਿਰ ਮੈਂ ਬਾਅਦ ਵਿੱਚ ਬੇਟੀ ਵਾਸਤੇ ਸ਼ਰੱਗ ਬਣਾਇਆ ਫਿਰ ਕੈਪ ਬਣਾਈ ਹੈ ਪਹੁੰਚੂ ਬਣਾਏ ਆ ਮਤਲਬ ਕਿ ਮੇਰੀ ਇਸ ਇਹ ਕਹਿ ਸਕਦੇ ਹਾਂ ਕਿ ਮੇਰੀ ਇੱਕ ਫਰੈਂਡ ਨੇ ਸਿਰਫ ਮੈਨੂੰ ਇੱਕ ਸੁਝਾਉ ਦਿੱਤਾ ਸੀ ਕਿ ਤੁਸੀਂ ਨਾ ਯੂਟਿਊਬ ਤੋਂ ਵੇਖ ਕੇ ਬਣਾ ਸਕਦੇ ਹੋ ਇੱਕ ਉਹਨਾਂ ਨੇ ਐਨਾ ਇਨਕਰਜ ਕੀਤਾ ਕਿ ਹੁਣ ਉਹ ਦੇਖ ਕੇ ਮੈਂ ਅੱਜ ਬਣਾ ਰਹੀ ਹਾਂ